ਮੇਰੀ ਯਾਦਗਾਰ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਈ ਸੀ ਮੈਨੂੰ ਉੱਥੇ ਬਹੁਤ ਹੀ ਵਧੀਆ ਲੱਗਿਆ ਗੁਰੂ ਸਾਹਿਬ ਜੀ ਦੇ ਅਸੀਂ ਸ਼ਸਤਰ ਦੇਖੇ ਗੁਰਦੁਆਰੇ ਦੇਖੇ ਔਰ ਉੱਥੇ ਦੇ ਲੰਗਰ ਹਾਲ ਬਹੁਤ ਹੀ ਵਧੀਆ ਸੀ ਉੱਥੇ ਅਸੀਂ ਜਾ ਕੇ ਕਾਫੀ ਸਾਰੀ ਸ਼ੋਪਿੰਗ ਕੀਤੀ ਸਾਨੂੰ ਦੁਕਾਨਦਾਰ ਵੀ ਬਹੁਤ ਵਧੀਆ ਸੀ ਕੋਪ੍ਰੇਟਿਵ ਸੀਗੇ ਉਹਨਾਂ ਨੂੰ ਪਤਾ ਸੀ ਕਿ ਇਹ ਪੰਜਾਬ ਤੋਂ ਆਏ ਹੋਏ ਹਨ ਉਹਨਾਂ ਨੇ